ਅਸੀਂ ਬਚਪਨ ਤੋਂ ਹੀ ਆਪਣੇ ਸਿੱਖ ਇਤਿਹਾਸ ਬਾਰੇ ਆਪਣੇ ਬਜ਼ੁਰਗਾਂ ਤੋਂ ਸਿੱਖਣ ਦਾ ਅਨੰਦ ਮਾਣਿਆ ਹੈ ਸਾਡੇ ਬਜ਼ੁਰਗਾਂ ਦੁਆਰਾ ਸਾਨੂੰ ਸਿੱਖ ਇਤਿਹਾਸ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਸੀ ਸਾਨੂੰ ਸ ਸਭ ਤੋਂ ਵੱਧ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਹਾਣੀ ਬਹੁਤ ਹੀ ਜ਼ਿਆਦਾ ਮਨ ਨੂੰ ਦੁੱਖ ਪਹੁੰਚਾਉਂਦੀ ਹੈ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗਾਥਾ ਸੁਣਦੇ ਹੋਏ ਮਾ ਇੱਕ ਵਾਰੀ ਮਨ ਹੈ ਜਿਹੜਾ ਉਹ ਵਲੂੰਦਰਿਆ ਜਾਂਦਾ ਹੈ ਸ ਛੋਟੇ ਸਹਿਬਜ਼ਾਦੇ ਜਿਹੜੇ ਕਿ ਹਜੇ ਸਿਰਫ ਸੱਤ ਅਤੇ ਨੌ ਸਾਲ ਦੀ ਉਮਰ ਵੇ ਦੇ ਵਿੱਚ ਨੀਹਾਂ ਦੇ ਵਿੱਚ ਚਿਣੇ ਗਏ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਸਕਾਰ ਦੇ ਲਈ ਟੋਡਰ ਮੱਲ ਵੱਲੋਂ ਜਗ੍ਹਾ ਮੋਹਰਾਂ ਸੋਨੇ ਦੀਆਂ ਮੋਹਰਾਂ ਨੂੰ ਖੜ੍ਹਾ ਕਰਕੇ ਫਿਰ ਉਸ ਜਗ੍ਹਾ ਨੂੰ ਮੁੱਲ ਖਰੀਦ ਕੇ ਫਿਰ ਉਹਨਾਂ ਦਾ ਸਸਕਾਰ ਕੀ ਕਰਿਆ ਜਾਣਾ ਸਾਡੇ ਬਜ਼ੁਰਗਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਹੜਾ ਟੋਡਰ ਮੱਲ ਸੀ ਉਸਨੇ ਭੀਖ ਮੰਗ ਕੇ ਮੋਹਰਾਂ ਮੁੱਲ ਦੀ ਤਾਂ ਕਿਤੇ ਜਾ ਕੇ ਇਹ ਆਪਣੇ ਜਗ੍ਹਾ ਮੁੱਲ ਖਰੀਦ ਕੇ ਉਹਨਾਂ ਦਾ ਸਸਕਾਰ ਕੀਤਾ ਗਿਆ ਇਸੇ ਤਰ੍ਹਾਂ ਵੱਡੇ ਸ ਸਾਹਿਬਜ਼ਾਦੇ ਸੀ ਜਿਹੜੇ ਉਹ ਵੀ ਕੋਈ ਬਹੁਤ ਜ਼ਿਆਦਾ ਉਮਰ ਦੇ ਨਹੀਂ ਸਨ ਸਿਰਫ ਪੰਦਰਾਂ ਅਤੇ ਸਤਾਰਾਂ ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਜਿਹੇ ਜੋਸ਼ ਦੇ ਨਾਲ ਲੜੇ ਕਿ ਦੁਸ਼ਮਣਾਂ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਉਹਨਾਂ ਨੇ ਪੂਰੀ ਬਹਾਦਰੀ ਦੇ ਨਾਲ ਆਪਣੀ ਚਮਕੌਰ ਸਾਹਿਬ ਦੀ ਜੰਗ ਹੈ ਜਿਹੜੀ ਉਹ ਲੜੀ ਅਤੇ ਆਪਣੀ ਸ਼ਹੀਦੀਆਂ ਨੂੰ ਪ੍ਰਾਪਤ ਕਰ ਗਏ ਇਹ ਅਜਿਹੀਆਂ ਕਥਾਵਾਂ ਹਨ ਜਿਹੜੀਆਂ ਕਿ ਸਾਡੇ ਸਿੱਖ ਇਤਿਹਾਸ ਦੇ ਲਈ ਅੱਗੇ ਅ ਬਹੁਤ ਜ਼ਿਆਦਾ ਪ੍ਰੇਰਨਾ ਦਾ ਕੰਮ ਕਰਦੀਆਂ ਹਨ